ਭਾਰਤ ਦਾ ਜਿਹੜਾ ਇਤਿਹਾਸ ਰਿਹਾ ਕੁਰਬਾਨੀਆਂ ਦਾ ਇਤਿਹਾਸ ਰਿਹਾ ਭਾਰਤ ਦਾ ਜਿਹੜਾ ਇਤਿਹਾਸ ਉਹਦੇ ਵਿੱਚ ਕੁਰਬਾਨੀਆਂ ਹੀ ਰਹੀਆਂ ਕਿਉਂਕਿ ਜਿਹੜੇ ਅੱਜ ਦੇ ਟਾਈਮ ਤੋਂ ਪਹਿਲੇ ਗੱਲ ਕਰੀਏ ਤਾਂ ਮੁਗਲਾਂ ਨੇ ਅੰਗਰੇਜ਼ਾਂ ਨੇ ਸਾਡੇ ਜਿਹੜੇ ਦੇਸ਼ਾਂ ਉੱਤੇ ਕਾਫੀ ਹਮਲੇ ਕੀਤੇ ਆ ਜਿਸ ਕਾਰਨ ਸਾਡੇ ਦੇਸ਼ ਦੇ ਲੋਕਾਂ ਨੇ ਕਾਫੀ ਕੁਰਬਾਨੀਆਂ ਦਿੱਤੀਆਂ ਖਾਸਕਰ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਸਿੱਖਾਂ ਨੇ ਕਾਫੀ ਕੁਰਬਾਨੀਆਂ ਦਿੱਤੀਆਂ ਆਪਣੇ ਦੇਸ਼ ਨੂੰ ਬਚਾਉਣ ਲਈ ਭਾਰਤ ਦਾ ਇਤਿਹਾਸ ਕਾਫੀ ਕਾਫੀ ਦਰ ਦਰਦਨਾਇਕ ਰਿਹਾ ਹੋਇਆ ਅਤੇ ਲੋਕ ਕਾਫੀ ਉਹਦੇ ਵਿੱਚ ਮਰੇ ਵੀ ਹਨ ਪਰ ਕਾਫੀ ਗਰਵ ਵੀ ਹੁੰਦਾ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਹਨ ਕਾਫੀ ਬਹਾਦਰ ਰਹੇ ਹਨ ਕਿੰਨੀ ਕਿੰਨੀ ਲੱਖਾਂ ਲੱਖਾਂ ਫੌਜਾਂ ਨਾਲ ਕਿੰਨੇ ਕਿੰਨੇ ਸਿੱਖ ਲੜ ਕਿੰਨੇ ਕਿੰਨੇ ਘੱਟ ਘੱਟ ਸਿੱਖ ਕਿੰਨੇ ਕਿੰਨੇ ਲੋਕ ਲੜ ਪੈਂਦੇ ਸੀ ਉਹ ਚੀਜ਼ ਸੋਚ ਕੇ ਸਾਨੂੰ ਕਾਫੀ ਅੱਛਾ ਮਹਿਸੂਸ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਕਾਫੀ ਅੱਛੇ ਲੋਕ ਅਤੇ ਕਾਫੀ ਬਹਾਦਰ ਲੋਕ ਹੈਗੇ ਹਨ ਜੋ ਸਾਨੂੰ ਇੱਕ ਉਮੀਦ ਦਿੰਦੇ ਹਨ ਕਿ ਆਪਾਂ ਵੀ ਘੱਟ ਨਹੀਂ ਹਾਂ ਆਪਾਂ ਵੀ ਆਪਣੇ ਦੇਸ਼ ਲਈ ਕੁਰਬਾਨੀਆਂ ਦੇ ਸਕਦੇ ਹਨ ਅਤੇ ਲੋਕਾਂ ਨੂੰ ਬਚਾ ਸਕਦੇ ਹਨ ਅੱਜ ਵੀ ਅਗਰ ਸਾਡੇ ਦੇਸ਼ ਦੀ ਕੋਈ ਹਮਲਾ ਕਰੇ ਜਾਂ ਕੁਛ ਕਰੇ ਸਾਡੇ ਦੇਸ਼ ਵਿੱਚ ਅੱਜ ਵੀ ਉਸ ਤਰ੍ਹਾਂ ਦੇ ਲੋਕ ਹੈ ਜੋ ਸਾਡੇ ਦੇਸ਼ ਵਿੱਚ ਕੁਰਬਾਨੀਆਂ ਦੇ ਕੇ ਆਪਣੇ ਦੇਸ਼ ਨੂੰ ਬਚਾ ਸਕਦੇ ਹਨ ਜਿੱਦਾਂ ਹੁਣ ਪ ਕਿੰਨੇ ਟ ਸਮੇਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪਣੇ ਪੰਜਾਬ ਲਈ ਆਪਣੇ ਮਲ ਕਿ ਧਰਮ ਨਾ ਚੇਂਜ ਕੀਤੇ ਕਰਦੇ ਹੋਏ ਆਪਣੇ ਪਰਿਵਾਰ ਨੂੰ ਮਲ ਕਿ ਸ਼ਹੀਦ ਕਰਾਤਾ ਸੀ ਸ਼ਹੀਦ ਕਰਾਤਾ ਮਤਲਬ ਕਿ ਸ ਸ਼ਹੀਦ ਹੋ ਗਏ ਸੀ ਉਹਦੇ ਵਿੱਚ ਅਤੇ ਉਹ ਚੀਜ਼ ਕਾਫੀ ਦਰਦਨਾਕ ਸੀਗੀ ਉਹ ਚੀਜ਼ ਵਿੱਚ ਕਾਫੀ ਦੁੱਖ ਪਹੁੰਚਿਆ ਕਿ ਸਾਡੇ ਦੇਸ਼ ਲਈ ਸਾਡੇ ਲਈ ਇਹ ਚੀਜ਼ਾਂ ਸੋਚ ਕੇ ਸਾਨੂੰ ਕਾਫੀ ਹੁੰਦਾ ਕਿ ਸਾਨੂੰ ਵੀ ਆਪਣੇ ਦੇਸ਼ ਲਈ ਕੁਛ ਕਰਨਾ ਚਾਹੀਦਾ